ਹਾਂ ਮੈਨੂੰ ਸਭ ਤੋਂ ਮਾਣ ਵਾਲੀ ਪ੍ਰਾਪਤੀ ਜੋ ਕਿ ਮੈਂ ਫੌਜ ਦੇ ਵਿੱਚ ਸੂਬੇਦਾਰ ਮੇਜਰ ਰੈਂਕ ਪ੍ਰਾਪਤ ਕਰਕੇ ਆਇਆ ਹਾਂ ਔਰ ਮੈਂ ਨੇਨਟੀਨ ਸਿਖਲਾਈ ਇਰੇਜ਼ ਕੀਤੀ ਜਿਸਦੇ ਵਿੱਚ ਮੈਂ ਪਹਿਲਾ ਸੂਬੇਦਾਰ ਮੇਜਰ ਸੀ ਔਰ ਮੈਨੂੰ ਖੁਸ਼ੀ ਆ ਕਿ ਯੂਨਿਟ ਇਸ ਸਮੇਂ ਬਹੁਤ ਵਧੀਆ ਕੰਮ ਕਰਦੀ ਹੈ ਔਰ ਜ਼ਿਆਦਾਤਰ ਸਮਾਂ ਮੇਰਾ ਟਰੇਨਿੰਗ ਵਿੱਚ ਰਿਹਾ ਹੈ ਔਰ ਸਪੋਟਸ ਦੇ ਵਿੱਚ ਸੱਠ ਕਿਲੋਮੀਟਰ ਕਮਾਂਡੋ ਚੇਲੈਂਜ ਦੋ ਹਜ਼ਾਰ ਦੋ ਅਕਤੂਬਰ ਦੋ ਹਜ਼ਾਰ ਚੌਦਾਂ ਵਿੱਚ ਪੂਰਾ ਕੀਤਾ ਸੀ